ਹੈਲੋ ਗੁਡ ਗੁਡ ਆਫਟਰ ਨੂਨ ਸਰ ਅਤੇ ਸਰ ਮੇਰਾ ਨਾਮ ਰਵੀ ਹੈ ਅਤੇ ਮੈਂ ਆਪਣੇ ਇੱਕ ਮਾਲਕ ਮੇਰੇ ਮਾਲਕ ਨੇ ਉਹਨਾਂ ਨੂੰ ਆਪਣੇ ਆਧਾਰ ਕਾਰਡ ਦੀ ਇੱਕ ਸਕੈਨ ਕਾਪੀ ਜਿਹੜੀ ਹੈ ਦਿੱਤੀ ਹੈ ਅਤੇ ਉਹਨਾਂ ਨੂੰ ਕੁਛ ਕੰਮ ਕਰਕੇ ਅਤੇ ਓਰਿਜਨਲ ਸਕੈਨ ਕੋਪੀ ਜਿਹੜੀ ਮੈਂ ਜਿਹੜੀ ਇਸਦੀ ਇਸਦੀ ਸੂਚਨਾ ਤੁਹਾਨੂੰ ਤਾਂ ਦੇ ਰਿਹਾ ਜੀ ਕਿ ਉਸਦਾ ਕੋਈ ਗਲਤ ਉਪਯੋਗ ਨਾ ਕਰੇ ਅਤੇ ਕੱਲ੍ਹ ਨੂੰ ਮੈਨੂੰ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਮੈਂ ਤੁਹਾਨੂੰ ਸੂਚਿਤ ਕਰ ਰਿਹਾ ਸਰ ਅਤੇ ਮੈਨੂੰ ਤੁਹਾਡੇ ਨਾਲ ਹੋਰ ਵੀ ਇੱਕ ਜਾਣਕਾਰੀ ਚਾਹੀਦੀ ਸੀ ਕਿ ਇਹ ਕਾਪੀ ਅਧਾਰ ਕਾਰਡ ਸਕੈਨ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਅਤੇ ਇਸ ਦੀ ਤੁਹਾਨੂੰ ਜਿਹੜੀ ਖ਼ਬਰ ਕਰਨ ਦੀ ਜਿਹੜੀ ਮੈਂ ਤੁਹਾਨੂੰ ਖ਼ਬਰ ਸੰਦੇਸ਼ ਦਿੱਤੀ ਹੈ ਜਿਸ ਨੇ ਜਿਹਦੀ ਕਿ ਐਪਲੀਕੇਸ਼ਨ ਕਿਵੇਂ ਮੈਂ ਡਾਊਨਲੋਡ ਕਰ ਸਕਦਾ ਕਿ ਤੁਸੀਂ ਮੈਨੂੰ ਮੈਨੂੰ ਮਾਰਗਦਰਸ਼ਨ ਕਰ ਸਕਦੇ ਹੋ ਜਿਸ ਨਾਲ ਮੈਂ ਜਿਹੜਾ ਕਿ ਕੱਲ੍ਹ ਉਹ ਅਗਰ ਕੋਈ ਸਮੱਸਿਆ ਨਾ ਹੋਵੇ ਤਾਂ ਮੈਂ ਇੱਕ ਸੇਫ ਰਹਿ ਸਕਾਂ ਮਹਿਫੂਜ਼ ਰਹਿ ਸਕਾਂ ਹਾਂਜੀ ਠੀਕ ਹੈ ਸਰ ਜਿਵੇਂ ਤੁਸੀਂ ਦੱਸ ਰਹੇ ਹੋ ਮੈਂ ਉਸ ਤਰ੍ਹਾਂ ਕਰੂੰਗਾ ਅਤੇ ਆਪਣੀ ਜਿਹੜੀ ਐਪਲੀਕੇਸ਼ਨ ਦੀ ਜਿਹੜੀ ਅਰਜੀ ਦੀ ਜਿਹੜੀ ਡਾਊਨਲੋਡ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਕੇ ਮੈਂ ਸੇਵ ਕਰਕੇ ਰੱਖ ਲਊਂਗਾ ਥੈਂਕ ਯੂ ਸਰ ਧੰਨਵਾਦ ਤੁਹਾਡਾ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਸ਼ੁਕਰੀਆ ਓਕੇ ਸਰ ਠੀਕ ਹੈ